ਪਾਣੀ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਕਾਫ਼ੀ ਜ਼ਰੂਰਤ ਹੈ ਸਾਨੂੰ ਸਵੇਰੇ ਤੋਂ ਲੈ ਕੇ ਰਾਤ ਦੇ ਸੌਣ ਤੱਕ ਪਾਣੀ ਦੀ ਕਾਫ਼ੀ ਵਰਤੋਂ ਕਰਨੀ ਪੈਂਦੀ ਹੈ ਜਿਵੇਂ ਕਿ ਅਸੀਂ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਬਰੱਸ਼ਿਸ਼ ਕਰਦੇ ਹਾਂ ਮੂੰਹ ਹੱਥ ਧੋਂਦੇ ਹਾਂ ਉਹਦੇ ਵਾਸਤੇ ਵੀ ਪਾਣੀ ਚਾਹੀਦਾ ਹੈ ਫਿਰ ਜਦੋਂ ਅਸੀਂ ਰਸੋਈ ਦੇ ਵਿੱਚ ਬਰਤਨ ਮਾਂਜਦੇ ਹਾਂ ਉਹਦੇ ਵਾਸਤੇ ਵੀ ਪਾਣੀ ਚਾਹੀਦਾ ਹੈ ਘਰ ਦੀ ਸਾਫ਼ ਸਫ਼ਾਈ ਵਿੱਚ ਜਿਵੇਂ ਕਿ ਅਸੀਂ ਘਰ ਦੀ ਸਾਫ਼ ਸਫ਼ਾਈ ਵਿੱਚ ਪੋਚਾ ਲਗਾਉਦੇ ਹਾਂ ਉਹਦੇ ਵਿੱਚ ਵੀ ਪਾਣੀ ਦੀ ਅਹਿਮ ਭੂਮਿਕਾ ਹੈ ਅਤੇ ਖਾਣਾ ਬਣਾਉਣ ਵਾਸਤੇ ਵੀ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਕੱਪੜੇ ਵੀ ਜਦੋਂ ਸਾਡੇ ਗੰਦੇ ਹੋ ਜਾਣ ਤਾਂ ਉਹਨਾਂ ਨੂੰ ਵੀ ਸਾਫ਼ ਕਰਨ ਵਾਸਤੇ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਪਾਣੀ ਕਿਵੇਂ ਬਚਾ ਸਕਦੇ ਹਾਂ ਪਾਣੀ ਆਪਾਂ ਬਚਾ ਸਕਦੇ ਹਾਂ ਕਿ ਜਿਹੜਾ ਕੱਪੜਿਆਂ ਵਾਲਾ ਪਾਣੀ ਹੈ ਉਹ ਅਸੀਂ ਪੋਚਿਆ ਵਿੱਚ ਇਸਤੇਮਾਲ ਕਰ ਸਕਦੇ ਹਾਂ ਅਤੇ ਗੁਰਬਾਣੀ ਵਿੱਚ ਵੀ ਪਾਣੀ ਨੂੰ ਜਿਹੜਾ ਪਿਤਾ ਦਾ ਸਮਾਨ ਦਰਜਾ ਦਿੱਤਾ ਗਿਆ ਹੈ ਕਿਉਂਕਿ ਕਿਹਾ ਗਿਆ ਹੈ ਪਵਣੁ ਗੁਰੂ ਪਾਣੀ ਪਿਤਾ ਅਤੇ ਹੋਰ ਵੀ ਕਿਹਾ ਗਿਆ ਹੈ ਕਿ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ਪਾਣੀ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਪੇੜ ਪੌਦਿਆਂ ਨੂੰ ਵੀ ਪਾਣੀ ਦੀ ਜ਼ਰੂਰਤ ਪੈਂਦੀ ਹੈ